ਹੈਲੋ ਤੁਸੀਂ ਬੁਕਸ ਸਟੋਰ ਤੋਂ ਬੋਲ ਰਹੇ ਹੋ ਮੈਨੂੰ ਐਮ ਏ ਦੀਆਂ ਬੁੱਕਸ ਚਾਹੀਦੀ ਆ ਨੇ ਥਰਡ ਸਮੈਸਟਰ ਦੀਆਂ ਪੋਲ ਸਾਇੰਸ ਰਾਜ ਪਰਮੇਸ਼ਰ ਸੈਕਿੰਡ ਹੈਂਡ ਹੋਣਗੀਆਂ ਇੰਟਰਨੈਸ਼ਨਲ ਪੋਲਟੀਕਲ ਕੰਪੈਲਟੀ ਪੋਲੀਟੀਕਲ ਡੈਮੋਕਰੇਸੀ ਇੰਡੀਆ ਬਸ ਇਹ ਤਿੰਨ ਹਾਂਜੀ ਇਹ ਪੰਜਾਬ ਯੂਨਿਵਰਸਿਟੀ ਚੰਡੀਗੜ੍ਹ ਚਾਹੀਦੀ ਹੈ ਤੇ ਕੁਝ ਮੇਰੇ ਨਾ ਦੋਸਤ ਨੇ ਵੀ ਲੈਣੀਆਂ ਨੇ ਬੁਕਸ ਬੀ ਏ ਦੀਆਂ ਫੋਰਥ ਸਮੈਸਟਰ ਦੀਆਂ ਤੇ ਥਰਡ ਸਮੈਸਟਰ ਦੋਨਾਂ ਦੀਆਂ ਸੈਕਿੰਡ ਹੈਂਡ ਲੈਣੀਆਂ ਨੇ ਪਰ ਹਾਂਜੀ ਮੇਰੀ ਬੁਕਸ ਦੇ ਪ੍ਰਾਈਜ ਕੀ ਹੋਏਗਾ ਸਰ ਤਿੰਨਾਂ ਦਾ ਹਾਂਜੀ ਜੇ ਬੁਕਸ ਫੋਟੋ ਸਟੇਟ ਕਰਵਾ ਲਈਏ ਫਿਰ ਕਿੰਨੇ ਕੁ ਮਤਲਬ ਮਤਲਬ ਮੇਰੇ ਪੇਪਰ ਨੇੜੇ ਨੇ ਤੇ ਕਿੰਨੀ ਦੇਰ ਮਤਲਬ ਲੱਗ ਗਈ ਫੋਟੋ ਸਟੇਟ ਕਰਾਉਣ ਚ

ਚਲੋ ਠੀਕ ਹੈ ਆਏ ਕਰੋ ਤੁਸੀਂ ਸੇਕਿੰਡ ਹੈਂਡ ਬੁਕਸ ਹੀ ਪਤਾ ਕਰ ਕੇ ਦੱਸ ਦੋ ਤੇ ਕਿੰਨੇ ਦਿਨ ਤੱਕ ਲੈਣ ਆਵਾ ਨਹੀਂ ਥੋੜਾ ਜਲਦੀ ਕਰੋ ਪੇਪਰ ਨੇ ਚਾਰ ਪੰਜ ਦਿਨ ਤੱਕ ਦੋ ਸੌ ਦਬਾ ਕੱਲ ਤੱਕ ਕਰ ਦੋ ਤੇ ਚਾਰ ਪੰਜ ਦਿਨ ਦਾ ਅੰਦਰ ਕਰ ਦੋ ਚਲ ਠੀਕ ਹੈ ਐਸੇ ਨੰਬਰ ਤੇ ਫੋਨ ਕਰਦੇ ਆ ਜੀ ਜਦੋਂ ਵੀ ਮਿਲ ਜਾਣ ਹੋ ਸਕੇ ਜਲਦੀ ਕਰ ਦਿਓ ਜੀ ਓਕੇ ਥੈਂਕਯੂ